ਹਾਂ ਸਾਡੇ ਖੇਤਰ ਦੇ ਦੁਸਹਿਰੇ ਦੇ ਮੇਲੇ 'ਤੇ ਆਰਨੇਟ ਜਸਮੀਨ ਸੈਂਡਲ ਅਤੇ ਖੂ ਅਤੇ ਹੋਰ ਕਈ ਸਾਡੇ ਖੇਤਰ ਵਿੱਚ ਪ੍ਰੋਗਰਾਮ ਹੁੰਦੇ ਰਹਿੰਦੇ ਹਨ ਅਤੇ ਸਾਡੇ ਪਿੰਡ ਦੇ ਨਜ਼ਦੀਕ ਸਾਡੀ ਤਹਿਸੀਲ ਗਿੱਦੜਬਾਹਾ ਹੈ ਜੋ ਕਿ ਸੌ ਸਾਲ ਬਣੇ ਨੂੰ ਹੋਏ ਹਨ ਸੌ ਸਾਲ ਗਿੱਦੜਬਾਹਾ ਦਾ ਜਸ਼ਨ ਮਨਾਇਆ ਗਿਆ ਸੀ ਜਿਸ ਵਿੱਚ ਦੁਨੀਆਂ ਦੇ ਅਣਮੁੱਲੇ ਅਤੇ ਨਕੋਦਰ ਦੇ ਗਤਨਸ਼ੀਨ ਗੁਰਦਾਸ ਮਾਨ ਜੀ ਦਾ ਵੀ ਅਖਾੜਾ ਲਗਾਇਆ ਜੋ ਕਿ ਸਾਡੇ ਲਈ ਯਾਦਗਾਰ ਹੈ ਉਹ ਚਿਕ ਇੱਕ ਦੂਜੇ ਦੇ ਕਰਮ ਅਨੁਸਾਰ ਉਹ ਉੱਚੇ ਹੋਣ ਕਾਰਨ ਕਈ ਪ੍ਰਕਾਰ ਦੀਆਂ ਸੁਰਾਂ ਲਹਿਰਾਂ ਪੈਦਾ ਕਰਦੇ ਹਨ ਮਨੁੱਖ ਨੂੰ ਇਸ ਇਸ ਨੂੰ ਵੇਖ ਕੇ ਅਤੇ ਸੁਣ ਕੇ ਗਾਉਣਾ ਸ਼ੁਰੂ ਕੀਤਾ ਸੀ ਇਸ ਲਈ ਇਸ ਕਲਾ ਨੂੰ ਮਿਊਜਿਕ ਅਤੇ ਮੌਸ ਮੌਸਿਕੀ ਕਹਿੰਦੇ ਹਨ ਕੁਝ ਵਿਦਵਾਨਾਂ ਦੇ ਮਤ ਅਨੁਸਾਰ ਸੰਗੀਤ ਕਲਾ ਦਾ ਜਨਮ ਭਾਸ਼ਾ ਦੇ ਉਤਪਤੀ ਵਿੱਚੋਂ ਹੋਇਆ ਸੀ ਕੁਝ ਵਿਦਵਾਨਾਂ ਦੇ ਅਨੁਸਾਰ ਆਵਾਜ਼ ਦੀ ਉਤਪਤੀ ਦੇ ਨਾਲ ਹੀ ਸੰਗੀਤਾ ਦਾ ਜਨਮ ਹੁੰਦਾ ਹੈ